ਘਰੇਲੂ ਅਤੇ ਵਪਾਰਕ ਮੁਰਗੀ ਪਾਲਣ ਵਿੱਚ ਬਹੁਤ ਸਾਰੇ ਅੰਤਰ ਹਨ ਜਿਵੇਂ ਕਿ ਘਰੇਲੂ ਮੁਰਗੀ ਪਾਲਣ ਵਿੱਚ ਕੋਈ ਖਰਚਾ ਨਹੀਂ ਆਉਂਦਾ ਬਿਲਕੁਲ ਹੀ ਨਾ ਮਾਤਰ ਵਿੱਚ ਮੁਰਗੀ ਤਿਆਰ ਹੋ ਜਾਂਦੀ ਹੈ ਅਤੇ ਆਂਡੇ ਦੇਣ ਲੱਗ ਜਾਂਦੀ ਹੈ ਜਦੋਂ ਕਿ ਵਪਾਰਕ ਮੁਰਗੀ ਪਾਲਣ ਵਿੱਚ ਮੁਰਗੀ ਲਈ ਸਪੈਸ਼ਲ ਫੀਡ ਅਤੇ ਸਪੈਸ਼ਲ ਸੈਡ ਦਾ ਵੀ ਨਿਰਮਾਣ ਕਰਨਾ ਪੈਂਦਾ ਹੈ ਜਿਸ ਵਿੱਚ ਖਰਚਾ ਆਉਂਦਾ ਹੈ ਘਰੇਲੂ ਮੁਰਗੀ ਮਰਨ ਨਾਲ ਕੋਈ ਜ਼ਿਆਦਾ ਨੁਕਸਾਨ ਨਹੀਂ ਆਉਂਦਾ ਜਦੋਂ ਕਿ ਵਪਾਰਕ ਮੁਰਗੀ ਪਾਲਣ ਵਿੱਚ ਕਈ ਵਾਰ ਉਹ ਮਰ ਜਾਂਦੀ ਹੈ ਅਤੇ ਬਹੁਤ ਪੈਸਿਆਂ ਦਾ ਵੀ ਨੁਕਸਾਨ ਹੁੰਦਾ ਹੈ ਇਸ ਤੋਂ ਇਲਾਵਾ ਜਿਹੜੇ ਘਰੇਲੂ ਮੁਰਗੀ ਤੋਂ ਆਂਡੇ ਪ੍ਰਾਪਤ ਹੁੰਦੇ ਹਨ ਉਹਨਾਂ ਦੀ ਗੁਣਵੱਤਾ ਬਹੁਤ ਹੁੰਦੀ ਹੈ ਕਿਉਂਕਿ ਉਹ ਕਿਸੇ ਵੀ ਰੈਡੀਮੇਡ ਚੀਜ਼ ਦੁਬਾਰਾ ਨਹੀਂ ਬਣੇ ਹੁੰਦੇ ਹਨ ਜਦੋਂ ਕਿ ਵਪਾਰਕ ਮੁਰਗੀ ਪਾਲਣ ਵਿੱਚ ਉਹ ਬਹੁਤ ਸਾਰੇ ਉਹਨਾਂ ਨੂੰ ਟੀਕੇ ਵੀ ਲਗਾਏ ਜਾਂਦੇ ਹਨ ਜਿਸ ਤੋਂ ਉਹਨਾਂ ਤੋਂ ਵੱਧ ਤੋਂ ਵੱਧ ਆਂਡੇ ਪ੍ਰਾਪਤ ਕੀਤੇ ਜਾ ਸਕਣ ਘਰੇਲੂ ਪਾਲਣ ਮੁਰਗੀ ਵਿੱਚ ਆਂਡੇ ਬਹੁਤ ਘੱਟ ਪ੍ਰਾਪਤ ਹੁੰਦੇ ਹਨ ਕਿਉਂਕਿ ਮੁਰਗੀ ਇੱਕ ਦੋ ਦਿਨਾਂ ਬਾਅਦ ਹੀ ਆਂਡਾ ਦਿੰਦੀ ਹੈ ਜਦੋਂ ਕਿ ਵਪਾਰਕ ਮੁਰਗੀ ਰੋਜ਼ ਆਂਡੇ ਦੇਣ ਕਰਕੇ ਉਹਦੀ ਗੁਣਵੱਤਾ ਘੱਟ ਜਾਂਦੀ ਹੈ